ਮੈਂ ਤੁਹਾਡੇ ਰੈਸਟੋਰੈਂਟ ਦੀ ਔਨਲਾਈਨ ਐਪ ਤੋਂ ਲਗਭਗ ਸਵਾ ਅੱਠ ਖਾਣੇ ਦਾ ਓਰਡਰ ਦਿੱਤਾ ਸੀ ਅਤੇ ਤੁਹਾਡੇ ਰੈਸਟੋਰੈਂਟ ਦੀ ਔਨਲਾਈਨ ਐਪ ਦੇ ਉੱਤੇ ਸਾਫ ਸਾਫ ਮੈਨਸ਼ਨ ਹੈ ਕਿ ਜਦੋਂ ਵੀ ਕੋਈ ਓਰਡਰ ਕੀਤਾ ਜਾਊਗਾ ਤਾਂ ਉਹਦੇ ਤੋਂ ਲਗਭਗ ਤੀਹ ਮਿੰਟਾਂ ਦੇ ਅੰਦਰ ਅੰਦਰ ਖਾਣੇ ਦੀ ਡਿਲੀਵਰੀ ਕਰ ਦਿੱਤੀ ਜਾਊਗੀ ਅਤੇ ਫਿਰ ਵੀ ਮੇਰੇ ਮੇਰਾ ਖਾਣਾ ਲਗਭਗ ਨੌਂ ਵਜੇ ਦੇ ਕਰੀਬ ਪੁਹੰਚਿਆ ਹੈ ਇਹਦਾ ਮਤਲਬ ਇਹ ਕਿ ਖਾਣਾ ਪੰਤਾਲੀ ਮਿੰਟ ਦੇ ਅੰਦਰ ਪੰਤਾਲੀ ਮਿੰਟਾਂ ਦੇ ਅੰਦਰ ਪਹੁੰਚਿਆ ਅਤੇ ਮਤਲਬ ਤੀਹ ਮਿੰਟਾਂ ਦੇ ਹਿਸਾਬ ਨਾਲ ਪੰਦਰ੍ਹਾਂ ਮਿੰਟ ਲੇਟ ਹੈ ਇਹ ਤਾਂ ਮੇਰਾ ਘਰ ਕੋਈ ਬਹੁਤ ਦੂਰੀ 'ਤੇ ਵੀ ਨਹੀਂ ਹੈ ਫਿਰ ਵੀ ਮੇਰਾ ਖਾਣਾ ਲੇਟ ਪਹੁੰਚਿਆ ਹੈ ਅਤੇ ਜਦੋਂ ਖਾਣਾ ਪਹੁੰਚਿਆ ਤਾਂ ਉਹ ਠੰਡਾ ਵੀ ਹੋ ਚੁੱਕਿਆ ਸੀ ਤਾਂ ਇਸ ਗੱਲ ਨੂੰ ਥੋੜ੍ਹਾ ਜਿਹਾ ਧਿਆਨ ਵਿੱਚ ਰੱਖਦੇ ਹੋਏ ਆਪਣੇ ਡਿਲੀਵਰੀ ਵਰਕਰਾਂ ਨੂੰ ਸਮਝਾਇਆ ਜਾਵੇ ਤਾਂ ਕਿ ਅੱਗੇ ਤੋਂ ਇਹੋ ਜਿਹੀ ਗਲਤੀ ਨਾ ਹੋਵੇ ਅਤੇ ਕਸਟਮਰ ਕਸਟਮਰਾਂ ਦੀ ਸਮੇਂ ਦੀ ਬਰਬਾਦੀ ਨਾ ਹੋਵੇ